ਜਿਵੇਂ ਕਿ ਮੈਂ ਰੋਜ਼ ਰਨਿੰਗ ਕਰਨ ਲਈ ਆਪਣੇ ਅ ਸ਼ਹਿਰ ਦੇ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿੱਚ ਜਾਂਦਾ ਹਾਂ ਸਾਡ ਮੇਰਾ ਉਂ ਉੱਧਰ ਦਾ ਸ਼ਡਿਊਲ ਇਹ ਹੈ ਕਿ ਮੈਂ ਜਾਂਦੇ ਹੀ ਪਹਿਲਾਂ ਵੋਮ ਅਪ ਕਰਦਾ ਹਾਂ ਵੋਮ ਅਪ ਕਰਨ ਤੋਂ ਬਾਅਦ ਜਦੋਂ ਸਰੀਰ ਗਰਮ ਹੋ ਜਾਂਦਾ ਹੈ ਤਾਂ ਸਟੈਚਿੰਗ ਐਕਸਰਸਾਈਜ ਹੁੰਦੀ ਹੈ ਔਰ ਅ ਔਰ ਅਦਰ ਐਕਸਾਈਜ ਵੀ ਕਰਦੇ ਹਾਂ ਜੇਕਰ ਗੱਲ ਕੀਤੀ ਜਾਵੇ ਸਪ੍ਰਿੰਟ ਦੀ ਤਾਂ ਸਪ੍ਰਿੰਟ ਉਹ ਹੈ ਦੌੜ ਹੈ ਜਿਹਦੇ ਵਿੱਚ ਸੌ ਮੀਟਰ ਦੀ ਅ ਤੇਜ਼ ਦੌੜ ਹੁੰਦੀ ਹੈ ਯੇ ਪਰ ਪਰ ਸਪ੍ਰਿੰਟ ਕਰਦੇ ਵਕਤ ਇਹ ਧਿਆਨ ਜਰੂ ਜ਼ਰੂਰ ਦੇਣਾ ਚਾਹੀਦਾ ਹੈ ਕਿ ਸਰੀਰ ਤੁਹਾਡਾ ਵੋਮਅਪ ਹੋਵੇ ਕਿਉਂਕਿ ਵੋਮਅਪ ਸਰੀਰ ਨਹੀਂ ਹੋਏਗਾ ਤਾਂ ਇਸ ਨਾਲ ਤ ਤੁਹਾਨੂੰ ਇੰਜਰੀ ਦਾ ਵੀ ਖ਼ਤਰਾ ਰਹੇਗਾ ਇੰਜਰੀ ਦਾ ਵੀ ਖ਼ਤਰਾ ਰਹੇਗਾ ਇਸ ਕਰਕੇ ਮੈਂ ਸਰੀਰ ਨੂੰ ਵੋਮਅਪ ਕਰਨ ਤੋਂ ਬਾਅਦ ਰੋਜ਼ ਤਾਂ ਨਹੀਂ ਮਤਲਬ ਅਲਟਰਨੇਟਿਵ ਡੇ ਡੇਜ਼ 'ਤੇ ਅ ਸਪਰਿੰਟ ਕਰਦਾ ਹਾਂ ਸਪਰਿੰਟ ਨਾਲ ਸਰੀਰ ਵਿੱਚ ਅਲੱਗ ਹੀ ਤੰਦਰੁਸਤੀ ਆਉਂਦੀ ਹੈ ਸਪਰਿੰਟ ਨਾਲ ਜੋ ਆਪਣੀ ਅ ਲੈਗਸ ਦੀ ਲੈਗਸ ਬੋਨ ਹੈ ਉਹਦੇ ਵਿੱਚ ਮਜਬੂਤੀ ਆਉਂਦੀ ਹੈ ਅ ਸਪਰਿੰਟ ਨਾਲ ਹੀ ਅ ਰਨਿੰਗ ਰਨਿੰਗ ਨੂੰ ਤੇਜ਼ ਕਰਨ ਵਿੱਚ ਸਹਾਇਤਾ ਮਿਲਦੀ ਹੈ ਸਹਾਇਤਾ ਮਿਲਦੀ ਹੈ ਅਤੇ ਇਹ ਤੰਦਰੁਸਤ ਰਹਿਣ ਵਾਸਤੇ ਬਹੁਤ ਹੀ ਜ਼ਰੂਰੀ ਇੱਕ ਜ਼ਰੂਰੀ ਇੱਕ ਦੌੜ ਹੈ ਜਿਸ ਨਾਲ ਕਿ ਤੁਹਾਡੀ ਅ ਰਨਿੰਗ ਟਾਈਮ ਵੀ ਕੰਮ ਕੰਮ ਆਉਂਦਾ ਹੈ ਇਹਦੇ ਸਪਰਿੰਟ ਨਾਲ ਤਾਂ ਇਸ ਕਰਕੇ ਸਪਰਿੰਟ ਜਾਂ ਟਰੇਲ ਰਨਿੰਗ ਉਂ ਮੈਂ ਹਰ ਰੋਜ਼ ਤਾਂ ਨਹੀਂ ਮਤਲਬ ਕਦੇ ਕਦੇ ਕਰਦਾ ਹਾਂ ਇਸ ਨਾਲ ਬਹੁਤ ਫਾਇਦਾ ਮਿਲਦਾ ਹੈ ਧੰਨਵਾਦ